ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਬਿੱਲ ਇੱਕ ਥਰਡ ਪਾਰਟੀ ਐਪ ਤੋਂ ਭਰਿਆ ਸੀ ਪਰ ਇਸ ਪਾਣੀ ਦੇ ਬਿੱਲ ਦੀ ਐਂਟਰੀ ਰਿਕਾਰਡਾਂ ਵਿੱਚ ਸ਼ੋ ਨਹੀਂ ਹੋ ਰਹੀ ਜੋ ਕਿ ਮੈਨੂੰ ਲੇਟ ਫੀਸ ਬਾਰੇ ਟੈਂਸ਼ਨ ਹੋ ਰਹੀ ਹੈ ਅਤੇ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰੀ ਫੀਸ ਭਰੀ ਗਈ ਹੈ ਅਤੇ ਨਹੀਂ ਤਾਂ ਮੇਰੀ ਟਰਾਂਜੈਕਸ਼ਨ ਆਈ ਡੀ 'ਤੇ ਚੈੱਕ ਕੀਤਾ ਜਾਏ ਜੋ ਕਿ ਹੈ ਵੰਨ ਫੋਰ ਥਰੀ ਏਟ ਅਤੇ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਜਾਵੇ ਤਾਂ ਜੋ ਕਿ ਮੈਂ ਆਪਣਾ ਬਿੱਲ ਭਰੇ ਹੋਏ ਬਿਲ ਦੀ ਰਸੀਦ ਪਾ ਸਕਾਂ ਅਤੇ ਇਹਨੂੰ ਜਲਦੀ ਤੋਂ ਜਲਦੀ ਆਪਣੇ ਰਿਕਾਰਡਾਂ ਵਿੱਚ ਸ਼ੋ ਹੋਵੇ ਇਸ ਵਿੱਚ ਜਲ ਅਥਾਰਟੀ ਨੂੰ ਮੈਂ ਇਹ ਕਰਨਾ ਚਾਹਾਂਗਾ ਕਿ ਇਸ ਐਪ ਦੀ ਵਰਤੋਂ ਨੂੰ ਸਹੀ ਕੀਤਾ ਜਾਵੇ ਤਾਂ ਜੋ ਫੀਸ ਨਾਲ ਦੀ ਨਾਲ ਭਰੀ ਹੋਏ ਸ਼ੋ ਹੋ ਜਾਵੇ ਅਤੇ ਇਸ ਲੇਟ ਫੀਸ ਉੱਤੇ ਨਰਮੀ ਪੇਸ਼ ਕੀਤੀ ਜਾਵੇ ਤਾਂ ਜੋ ਮੈਨੂੰ ਫਾਈਨ ਘੱਟ ਤੋਂ ਘੱਟ ਲੱਗਿਆ ਜਾਵੇ ਧੰਨਵਾਦ